ਹਾਂਜੀ ਸਮਾਜ ਵਿੱਚ ਸਾਡੇ ਪੰਜਾਬ ਵਿੱਚ ਕਈ ਪ੍ਰਕਾਰ ਦੀਆਂ ਸਕੀਮਾਂ ਹਨ ਕਈ ਪ੍ਰਕਾਰ ਦੀਆਂ ਸਕੋਲਰਸ਼ਿਪ ਸਕੀਮਾਂ ਹਨ ਬੀ ਪੀ ਐਲ ਜਿਹੜੇ ਇਹ ਨੇ ਬਿਲੋ ਪੋਵਰਟੀ ਲਾਈਨ ਦੇ ਲੋਕ ਉਹਨਾਂ ਨੂੰ ਕਈ ਤਰ੍ਹਾਂ ਦੇ ਵੇ ਉਹਨਾਂ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਜਿਹੜੀ ਹੈ ਕਾਫੀ ਹੱਦ ਤੱਕ ਫ੍ਰੀ ਕੀਤੀਆਂ ਗਈਆਂ ਹਨ ਕਿ ਬਾਰ੍ਹਵੀਂ ਤੱਕ ਦੀ ਸਿੱਖਿਆ ਕੁੜੀਆਂ ਲਈ ਸਪੈਸ਼ਲ ਲੜਕੀਆਂ ਲਈ ਫ੍ਰੀ ਹੈ ਜਿਹਨਾਂ ਵਿੱਚੋਂ ਉਹਨਾਂ ਦਾ ਕਿਤਾਬਾਂ ਵਰਦੀਆਂ ਵਿੱਦਿਆ ਸਾਰਾ ਕੁਛ ਫ੍ਰੀ ਦਿੱਤਾ ਗਿਆ ਏ ਉਹਨਾਂ ਨੂੰ ਵਿਦਿਆਰਥੀਆਂ ਨੂੰ ਹੋਰ ਵੀ ਕਈ ਅਜਿਹੀਆਂ ਸਕੀਮਾਂ ਹਨ ਜਿਵੇਂ ਕਿ ਉਹਨਾਂ ਨੂੰ ਸੁਕੰਨਿਆ ਸਮਰਿਧੀ ਸਕੀਮ ਏ ਇੱਕ ਹੈ ਜਿਹਦੇ ਵਿੱਚ ਇੱਕ ਸ਼ਗਨ ਸਕੀਮ ਹੈ ਜਿਹਦੇ ਵਿੱਚ ਉਹਨਾਂ ਨੂੰ ਵਿਆਹ ਵੇਲੇ ਸ਼ਗਨ ਦਿੱਤਾ ਜਾਂਦਾ ਹੈ ਉਹਨਾਂ ਨੂੰ ਵਿੱਦਿਆ ਫ੍ਰੀ ਐਜੂਕੇਸ਼ਨ ਪ੍ਰਾਪਤ ਕਰਨ ਲਈ ਹੀ ਸਕੋਲਸ਼ਿਪ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਾਈਕਲ ਉਹਨਾਂ ਨੂੰ ਸਿਲਾਈ ਕਢਾਈ ਸਕਿੱਲ ਵਰਕ ਵਾਸਤੇ ਵੀ ਉਹਨਾਂ ਨੂੰ ਪ੍ਰੋਪਰ ਸਾਧਨ ਮਹੁੱਈਆ ਕਰਵਾਏ ਜਾਂਦੇ ਹਨ ਹੋਰ ਵੀ ਵਿਦਿਆਰਥੀਆਂ ਨੂੰ ਨੂੰ ਸਹੀ ਸਿੱਖਿਆ ਪ੍ਰਾਪਤ ਕਰਨ ਲਈ ਅਨੇਕਾਂ ਪ੍ਰਕਾਰ ਦੀਆਂ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਧੰਨਵਾਦ